ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਅਗਸਤ ਉੱਨੀ ਸੌ ਸੰਨਤਾਲੀ ਤੇਈ ਨਵੰਬਰ ਦੋ ਹਜ਼ਾਰ ਪੰਜ ਬਾਈ ਅਪ੍ਰੈਲ ਦੋ ਹਜ਼ਾਰ ਨੌ ਤੇਰਾਂ ਜਨਵਰੀ ਉੱਨੀ ਸੌ ਅੱਸੀ